ਸਰਦੀਆਂ ਵਿੱਚ ਪੌਦਿਆਂ ਨੂੰ ਠੰਡ ਤੋਂ ਬਚਣ ਦੇ ਲਈ ਬਚਣ ਦੇ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਤੁਲਸੀ ਕੱਚੇ ਪੌਦੇ ਹੁੰਦੇ ਹਨ ਗੁਲਾਬ ਦਾ ਫੁੱਲ ਗੇਂਦੇ ਦਾ ਫੁੱਲ ਇਸ ਨੂੰ ਇਹ ਇਸ ਨੂੰ ਠੰਡ ਕੋਰੇ ਤੋਂ ਬਚਾਉਣ ਦੇ ਲਈ ਇਸ ਦੇ ਉੱਪਰ ਕੱਪੜਾ ਪਾਉਣ ਦੀ ਲੋੜ ਹੁੰਦੀ ਹੈ ਜਿਵੇਂ ਕਿ ਇਹਨੂੰ ਇਹ ਕੱਚਾ ਫਲ ਹੈ ਇਹ ਚ ਜਲਦੀ ਹੀ ਖਰਾਬ ਹੋ ਜਾਂਦਾ ਹੈ ਅਤੇ ਜਿਵੇਂ ਕਿ ਗਰਮੀਆਂ ਵਿੱਚ ਇਹ ਗਰਮੀਆਂ ਵਿੱਚ ਵੀ ਫਲ ਪੌਦਿਆਂ ਨੂੰ ਬਹੁਤ ਹੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਗਰਮੀ ਵਿੱਚ ਧੁੱਪ ਕਾਰਨ ਇਹ ਪੌਦੇ ਖਰਾਬ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਛਾਂ ਦੀ ਲੋੜ ਹੁੰਦੀ ਹੈ ਅਤੇ ਪਾਣੀ ਜ਼ਿਆਦਾ ਖੜ੍ਹਾ ਰਹਿਣ ਕਾਰਨ ਵੀ ਇਹ ਪੌਦੇ ਗਲ ਜਾਂਦੇ ਹਨ ਅਤੇ ਇਹਨਾਂ ਨੂੰ ਛਾਂ ਦੀ ਵੀ ਬਹੁਤ ਹੀ ਜ਼ਰੂਰਤ ਹੁੰਦੀ ਹੈ ਅਤੇ ਨਾ ਹੀ ਆਪਾਂ ਨੂੰ ਪਾਣੀ ਦੀ ਪਾਣੀ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ਹੀ ਇਹਦੇ ਇਸਦੇ ਵਿੱਚ ਜ਼ਿਆਦਾ ਪਾਣੀ ਖਿਲਾਰਨਾ ਚਾਹੀਦਾ ਹੈ ਅਤੇ ਇਸ ਇਸ ਕਰਕੇ ਇਹਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਇਹ ਪਾਣੀ ਨਾਲ ਇਹਦਾ ਬਹੁਤ ਹੀ ਨੁਕਸਾਨ ਹੁੰਦਾ ਹੈ